ਮੈਂ ਬੇਸੀਕਲੀ ਪੰਜਾਬ ਤੋਂ ਬਿਲੌਂਗ ਕਰਦਾ ਏ ਹਾਂ ਮੈਂ ਪੰਜਾਬ ਦਾ ਰਹਿਣ ਵਾਲਾ ਏ ਹਾਂ ਜੰਮਿਆਂ ਪਲਿਆਂ ਇੱਥੇ ਹੀ ਹਾਂ ਲੇਕਿਨ ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਨੂੰ ਉੱਤਰ ਪ੍ਰਦੇਸ਼ ਜਾਣਾ ਪਿਆ ਸੀ ਕਿਸੇ ਕੰਮ ਕਰਕੇ ਜਿੱਥੇ ਦਾ ਐਕਪੀਰੀਅਂਸ ਜਿਹੜਾ ਹੈ ਉਹ ਬਹੁਤ ਹੀ ਹੈਰਾਨੀਜਨਕ ਸੀਗਾ ਮੈਂ ਉੱਤੇ ਪਹੁੰਚਿਆ ਹੀ ਸੀ ਹਜੇ ਬੱਸ ਸਟੈਂਡ ਉੱਤਰਿਆ ਸੀ ਤਾਂ ਆਟੋ ਰਿਕਸ਼ਾ ਲਿਆ ਸੀ ਉਹ ਉੱਥੇ ਦੀ ਜਿਹੜੀ ਲੈਂਗੁਏਜ ਹੈ ਉਹ ਭੋਜਪੁਰੀ ਹੈ ਹਿੰਦੀ ਉਹਨਾਂ ਨੂੰ ਬਹੁਤ ਘੱਟ ਹੈ ਬੋਲਦੇ ਹੈ ਹਿੰਦੀ ਲੇਕਿਨ ਉਹਦੇ ਵਿੱਚ ਉਹ ਭੋਜਪੁਰੀ ਮਿਕਸ ਕਰ ਦਿੰਦੇ ਹੈ ਜੋ ਕਿ ਸਮਝਣੀ ਬੜੀ ਔਖੀ ਹੈ ਤਾਂ ਉਸ ਟਾਈਮ ਮੈਂ ਬਹੁਤ ਪ੍ਰੇਸ਼ਾਨ ਹੋਇਆ ਸੀ ਤਾਂ ਮੈਂ ਆਪਣੇ ਇੱਕ ਫ੍ਰੈਂਡ ਨੂੰ ਪੁੱਛਿਆ ਕਿ ਮੈਂ ਇੱਦਾਂ ਇੱਦਾਂ ਤੁਹਾਡੇ ਯੂ ਪੀ ਆਇਆਂ ਹੈ ਅਤੇ ਮੈਨੂੰ ਲੈਂਗੁਏਜ ਨਹੀਂ ਸਮਝ ਆ ਰਹੀ ਤਾਂ ਉਹਨੇ ਮੈਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਗੂਗਲ ਟ੍ਰਾਂਸਲੇਟ ਦਾ ਇਸਤੇਮਾਲ ਕਰੋ ਉਹਦੇ ਵਿੱਚ ਬੋਲ ਕੇ ਟ੍ਰਾਂਸਲੇਟ ਕਰਕੇ ਤੁਹਾਨੂੰ ਅਸਾਨ ਰਹੇਗਾ ਉਸ ਟਾਈਮ ਵੀ ਐਂ ਏ ਕਿ ਮੈਨੂੰ ਟੈਕਨੋਲਜੀ ਨੇ ਕਾਫ਼ੀ ਹੈਲਪ ਕੀਤੀ ਸੀਗੀ ਅਤੇ ਫਿਰ ਉਹ ਹੀ ਗੱਲ ਆ ਗਈ ਕਿ ਇਸ ਤਕਨੋਲਜੀ ਜਿਹੜੀ ਸਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਮੇਰਾ ਐਕਪੀਰੀਅਂਸ ਬਹੁਤ ਚੰਗਾ ਰਿਹਾ ਬੰਦੇ ਬਹੁਤ ਅੱਛੇ ਸਨ ਉੱਥੇ ਦੇ ਅਤੇ ਉਹਨਾਂ ਨੂੰ ਮਿਲਕੇ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਕੁਝ ਨਵਾਂ ਵੀ ਕਈ ਸ਼ਬਦ ਮੈਂ ਉੱਥੇ ਦੇ ਨਵੇਂ ਵੀ ਸਿੱਖੇ ਭੋਜਪੂਰੀ ਦੇ ਜੋ ਕਿ ਮੈਨੂੰ ਹੁਣ ਵੀ ਯਾਦ ਨੇ ਅਤੇ ਲਾਈਫ਼ ਦਾ ਬਹੁਤ ਅੱਛਾ ਐਕਪੀਰੀਅਂਸ ਰਿਹਾ ਮੇਰਾ